ਮੈਨੂੰ ਉੱਤਰੀ ਭਾਰਤੀ ਖਾਣੇ ਦੇ ਵਿੱਚ ਦਾਲ ਬਹੁਤ ਪਸੰਦ ਆ ਬਣਾਉਣੀ ਇਹਦਾ ਬਣਾਉਣ ਦਾ ਸੌਖਾ ਸਿੰਪਲ ਜਿਹਾ ਇਹਦੇ ਵਿੱਚ ਪਹਿਲਾਂ ਕੜਾਹੀ ਦੇ ਵਿੱਚ ਤੇਲ ਪਾਉਣਾ ਠੀਕ ਹੈ ਤੇਲ ਪਾ ਕੇ ਇਹਦੇ ਵਿੱਚ ਗੰਢਾ ਕੱਟ ਕੇ ਪਾ ਤਾ ਜੀ ਅਤੇ ਆਪਣਾ ਲਸਣ ਵਗੈਰਾ ਅਤੇ ਪਿਆਜ਼ ਆ ਆਹ ਆਪਣਾ ਉਹਨੂੰ ਹਿਲਾ ਲੈਣਾ ਚੰਗੀ ਤਰ੍ਹਾਂ ਠੀਕ ਹੈ ਜੀ ਅਦਰਕ ਪਾ ਤਾ ਹਰੀ ਮਿਰਚ ਪਾ ਤੀ ਅਤੇ ਆਪਣਾ ਫਿਰ ਕੀ ਕਰਨਾ ਜੀ ਉਹਨੂੰ ਬਣਾ ਕੇ ਜਦੋਂ ਮੰਨ ਲੈ ਵੀ ਬਣ ਜੇਗਾ ਤੜਕਾ ਉਹ ਤੋਂ ਬਾਅਦ ਟਮਾਟਰ ਪਾ ਦੇਣੇ ਆ ਜੀ ਟਮਟਰ ਪਾ ਕੇ ਜੀ ਚੰਗੀ ਤਰ੍ਹਾਂ ਉਹਨੂੰ ਤੜਕਾ ਫਿਰ ਮਸਾਲੇ ਪਾ ਦੇਣੇ ਮਸਾਲੇ ਪਾ ਕੇ ਜਦੋਂ ਬਣ ਗਈ ਜਿਹੜੀ ਆਪਾਂ ਦਾਲ ਭਿਉਂਤੀ ਹੈ ਜੀ ਅਤੇ ਉਹਦੇ ਵਿੱਚ ਦਾਲ ਪਾ ਲੈਣੀ ਆ ਠੀਕ ਹੈ ਜੀ ਕੁੱਕਰ ਦੇ ਵਿੱਚ ਪਾ ਦੇਣੀ ਆ ਅਤੇ ਉਹਦੇ ਵਿੱਚ ਪਾ ਕੇ ਅਤੇ ਉਹਦੀਆਂ ਮਤਲ ਕਿ ਵੀ ਸੀਟੀਆਂ ਬਣਾ ਦੇਣੀਆਂ ਅਤੇ ਥੋੜ੍ਹੇ ਟਾਈਮ ਬਾਅਦ ਸਰ ਬਣ ਜਾਂਦੀ ਆ ਸਿੰਪਲ ਜਿਹਾ ਤਰੀਕਾ ਅਤੇ ਵਧੀਆ ਬਣ ਜਾਂਦੀ ਆ ਅਤੇ ਇਹਨੂੰ ਖਾਣਾ ਸਾਰੇ ਪਸੰਦ ਕਰਦੇ ਹਾਂ ਥੈਂਕ ਯੂ ਸਰ